ਪ੍ਰਧਾਨ ਮੰਤਰੀ ਜਨ ਥਨ ਯੋਜਨਾ ਵਿੱਤੀ ਵਿਕਾਸ ਜਾਂ ਰਾਸ਼ਟਰੀ ਯੋਜਨਾ ਹੈ ਰਾਸ਼ਟਰ ਮਕਦ ਵੰਚਿਤ ਵਰਗ ਅਤੇ ਕਮਾਈ ਵਾਲੇ ਪਰਿਵਾਰਸ ਨੂੰ ਬੈਂਕਿੰਗ ਸੇਵਾ ਮੁੱਹਈਆਂ ਕਰਨਾ ਹੈ ਇਹ ਯੋਜਨਾ ਖਾਤੇ ਅਧੀਨ ਹੈ ਸਾਰੇ ਪਰਿਵਾਰ ਲਈ ਘੱਟ ਤੋਂ ਘੱਟ ਇੱਕ ਬੈਂਕ ਖਾਤਾ ਖੋਲਿਆ ਜਾਂਦਾ ਹੈ ਪੀਐਮ ਜੇਡੀ ਖਾਤਾ ਖੋਲਣ ਲਈ ਕਿਸੇ ਬੈਂਕ ਦੀ ਟੀਮ ਜਾਂ ਬੈਂਕ ਮਿੱਤਰ ਲੇਟ ਆਊਟ ਹੋ ਸਕਦਾ ਹੈ ਇਸ ਯੋਜਨਾ ਦੇ ਅਧੀਨ ਖਾਤੇਦਾਰਾਂ ਨੂੰ ਬੇਨਤੀ ਮਿਲਦੀ ਹੈ ਬੈਂਕ ਖਾਤੇ ਵਿੱਚ ਰਾਸ਼ੀ ਜਮ੍ਹਾਂ ਪਰ ਬੈਚ ਰੁਪਏ ਡੈਬਿਟ ਕਾਰਡ ਇੱਕ ਲੱਖ ਰੁਪਏ ਤੱਕ ਦਾ ਹਾਦਸਾ ਬੀਮਾ ਕਵਰ ਤੀਹ ਹਜ਼ਾਰ ਰੁਪਏ ਜੀਵਾ ਬੀਮਾ ਪੈਸੇ ਆਸਾਨੀ ਨਾਲ ਹੀ ਸਹੂਲਤ ਸਰਕਾਰੀ ਯੋਜਨਾਵਾਂ ਦੇ ਲਾਭਪਾਤਰ ਖਾਤੇ ਵਿੱਚ ਮਿਲਣਾ ਪੀਐਚਡੀ ਅਕਾਊਟ ਖੋਲਣ ਲਈ ਇੰਨ ਦਸਤਾਵੇਜ਼ਾਂ ਦੀ ਗੁਪਤਤਾ ਹੁੰਦੇ ਹਨ ਪਾਸਪੋਰਟ ਜਾਂ ਅਧਾਰ ਕਾਰਡ ਵਰਗੇ ਮਾਰਗ ਦਾ ਪ੍ਰਮਾਣ ਹੁੰਦਾ ਹੈ ਪੀਐਮ ਜੇਡੀ ਖਾਤਾ ਬਾਈ ਖੋਲਣ ਦਾ ਤਰੀਕਾ ਪੀਐਮ ਜੇਡੀ ਖਾਤਾ ਖੋਲਣ ਲਈ ਦਸਤਾਵੇਜ਼ ਤੋਂ ਖਾਤਾ ਈ ਖੋਲਣ ਦਾ ਫਾਰਮ ਲੈਣਾ ਜਨਧਨ ਯੋਜਨਾ ਵਿੱਤੀ ਸੇਵਾ ਵਿਕਾਵ ਵਿੱਤ ਮੰਤਰੀਆਂ ਅਨੁਵਾਦਿਤ ਐ ਸ਼ਾਮ ਜਨਧਨ ਯੋਜਨਾ ਜਿਵੇਂ ਕੀ ਯੋਜਨਾ ਦਾ ਭੁਗਤਾਨ ਜਨਧਨ ਵਿੱਤੀ ਯੋਜਨਾ ਦਾ ਪ੍ਰਬੰਧਨ ਹੈ ਜੋ ਕੀ ਉਹ ਯੋਗ ਤਰੀਕੇ ਨਾਲ ਵਿੱਤੀ ਸੇਵਾਵਾਂ ਦੇ ਰੂਪ ਨਾਮ ਵਿੱਚ ਬੈਂਕਿੰਗ ਬਚਤ ਜਦ ਕੀ ਜਮ੍ਹਾ ਖਾਤਾ ਵੀ ਪਰੇਸ਼ਨ ਕਰਜਾ ਬੀਮਾ ਪੈਨਸ਼ਨ ਪਹੁੰਚ ਤੱਕ ਯਕੀਨੀ ਹੈ ਪੀਐਮ ਜਨਧਨ ਯੋਜਨਾ ਭਾਰਤੀ ਰਾਸ਼ਟਰੀ ਯੋਜਨਾ ਹੈ ਹੋਣ ਵਾਲੇ ਵਿਸ਼ੇਸ਼ ਲਾਭ ਕਈ ਤਰ੍ਹਾਂ ਦੇ ਇਸਦੇ ਵਿਸ਼ੇਸ਼ ਲਾਭ ਹਨ ਜਿਵੇਂ ਜਮ੍ਹਾਂ ਰਾਸ਼ੀ ਦੇ ਵਿਆਜ ਇੱਕ ਲੱਖ ਰੁਪਏ ਦਾ ਹਾਦਸਾ ਬੀਮਾ ਮਿਲਦਾ ਏ ਤੁਸੀਂ ਸਿਰਫ ਬਾਕੀ ਰਕਮ ਬਣਾ ਕੇ ਰੱਖਣ ਦੀ ਜ਼ੂਰਤ ਨਹੀਂ ਹੈ ਹਨਾ ਪਰ ਇਹ ਸਲਾਹ ਦਿੱਤੀ ਜਾਂਦੀ ਹੈ ਕੀ ਰੁਪਏ ਕਾਰਡ ਆਪਣੇ ਕੋਲ ਰੱਖੋ ਇਸ ਯੋਜਨਾ ਦਾ ਕਈ ਪੇਂਡੂ ਵਰਗਾਂ ਨੂੰ ਤੇ ਕਈ ਸ਼ਹਿਰੀ ਵਰਗਾਂ ਨੂੰ ਪਰਿਵਾਰਾਂ ਨੂੰ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਇਹ ਯੋਜਨਾ ਗਰੀਬ ਕਲਿਆਣ ਯੋਜਨਾ ਨਾਲੋਂ ਵੀ ਜ਼ਿਆਦਾ ਵਧੀਆ ਹੈ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਵੀ ਬਹੁਤ ਪ੍ਰਸਿੱਧ ਹੈ ਉਸਦਾ ਵੀ ਮੈਂ ਤੇ ਮੇਰੇ ਪਰਿਵਾਰ ਨੇ ਕਾਫੀ ਵਾਰੀ ਲਾਭ ਉਠਾਇਆ ਹੈ ਜਿਵੇਂ ਕੀ ਸਾਡਾ ਅਸੀਂ ਪਿੰਡ ਵਿੱਚ ਰਹਿੰਦੇ ਹਾਂ ਉੱਥੇ ਸਾਨੂੰ ਅਨ ਵੀ ਮੁਹੱਈਆ ਕੀਤਾ ਜਾਂਦਾ ਬਹੁਤ ਘੱਟ ਰੇਟਾਂ ਤੇ ਜਿਵੇਂ ਕੀ ਦੋ ਤਿੰਨ ਰੁਪਏ ਕਿੱਲੋ ਕਣਕ ਸਾਨੂੰ ਮਿਲ ਜਾਂਦੀ ਹੈ ਸਿਰਫ ਕੁਛ ਨਹੀਂ ਇੱਕ ਛੋਟੀ ਜੀ ਮਾਸੂਮ ਮਾਲੂਮ ਜੀ ਫੀਸ ਕਟਵਾਣੀ ਪੈਂਦੀ ਹੈ ਜਿਸ ਨਾਲ ਅਸੀਂ ਆਪਣੀ ਕਣਕ ਪ੍ਰਾਪਤ ਕਰ ਸਕਦੇ ਹਾਂ ਪੀਐਮ ਕਲਿਆਣ ਨਿਵਾਸ ਯੋਜਨਾ ਦਾ ਵੀ ਮੇਰੇ ਗੁਆਂਢੀ ਨੇ ਲਾਭ ਉਠਾਇਆ ਹੈ ਜਿਸ ਦੇ ਅਧੀਨ ਉਸਨੇ ਬੈਂਕ ਤੋਂ ਬਹੁਤ ਘੱਟ ਵਿਆਜ਼ ਦਰ ਤੇ ਮਤਲਬ ਸਰਕਾਰ ਪਾਸੋਂ ਈ ਸਮਝ ਲਓ ਬਹੁਤ ਘੱਟ ਵਿਆਜ਼ ਦਰ ਤੇ ਆਪਣੇ ਘਰ ਆਪਣੇ ਸਿਰ ਦੀ ਛੱਤ ਪੱਕੀ ਕਰਨ ਲਈ ਘਰ ਪੱਕਾ ਕਰਨ ਲਈ ਕਰਜਾ ਲਿਆ ਹੈ ਜਿਸ ਵਿੱਚੋਂ ਕਾਫੀ ਕਰਜਾ ਉਸਦਾ ਮਾਫ਼ ਵੀ ਹੋ ਚੁੱਕਿਆ ਹੈ ਇਹ ਸਕੀਮਾਂ ਪ੍ਰਧਾਨ ਮੰਤਰੀ ਜੀ ਵੱਲੋਂ ਗਰੀਬਾਂ ਦੇ ਕਲਿਆਣ ਦੇ ਲਈ ਬਾਰ ਬਾਰ ਗਰੀਬਾਂ ਨੂੰ ਮੁੱਹਈਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਦੇਸ਼ ਦਾ ਗਰੀਬ ਵੀ ਇਹਨਾਂ ਗਰੀਬਾਂ ਦਾ ਲਾਭ ਉਠਾ ਸਕੇ ਪਰੰਤੂ ਬਹੁਤ ਪਰਿਵਾਰ ਬਹੁਤ ਪਿਛੜੇ ਹੋਏ ਵਰਗ ਆਪਣੇ ਪਿੰਡਾਂ ਸ਼ਹਿਰਾਂ ਵਿੱਚ ਅਜਿਹੇ ਵੀ ਹਨ ਜਿਹਨਾਂ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੀ ਨਹੀਂ ਹੈ ਸੋ ਨੋਲੇਜ਼ ਓਫ ਲੈਕ ਓਫ ਨੋਲੇਜ ਕਰਕੇ ਉਹ ਇਹਨਾਂ ਸਕੀਮਾਂ ਦਾ ਲਾਭ ਉਠਾਉਣ ਤੋਂ ਵੰਛਿਤ ਰਹਿ ਜਾਂਦੇ ਹਨ